ਜੇ ਪੰਜਾਬ ਨੂੰ ਆਉਂਦੀ ਹੋਈ ਦੁਨੀਆਂ ਵਿੱਚ ਸਭ ਤੋਂ ਅੱਗੇ ਰੱਖ ਜਾਣਾ ਹੈ ਤਾਂ ਸਰਕਾਰੀ ਪਹਿਲ ਕਦਮੀਆਂ ਜਾਂ ਨੀਤੀਆਂ 'ਤੇ ਧਿਆਨ ਦੇਣ ਦੀ ਬਹੁਤ ਲੋੜ ਹੈ ਇਸ ਤੋਂ ਸਭ ਤੋਂ ਪਹਿਲਾਂ ਇਹਨਾਂ ਦੀ ਸ਼ੁਰੂਆਤ ਆਪਣੇ ਵਾਤਾਵਰਨ ਅਤੇ ਸਮਾਜਿਕ ਤੋਂ ਹੋਣੀ ਚਾਹੀਦੀ ਹੈ ਸਮਾਜਿਕ ਹੀ ਲੋਕਾਂ ਵਿੱਚ ਸਮਝ ਆਉਣੀ ਚਾਹੀਦੀ ਹੈ ਕਿ ਆਪਾਂ ਨੂੰ ਉਸ ਲੀਡਰ ਨੂੰ ਚੁਣਿਆ ਜਾਵੇ ਜਾਂ ਆਪਣੇ ਵਾਤਾਵਰਨ ਦਾ ਧਿਆਨ ਆਪ ਰੱਖਣਾ ਇਹ ਇੱਕ ਆਮ ਸਮਝ ਹੋਣੀ ਚਾਹੀਦੀ ਹੈ ਸਭਨਾਂ ਲੋਕਾਂ ਵਿੱਚ ਅਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਰਾਜਨੀਤੀ ਇੱਕ ਨੀਤੀਆਂ ਨੂੰ ਵੀ ਬਹੁਤ ਧਿਆਨ ਦੇਣਾ ਚਾਹੀਦਾ ਕਿਉਂਕਿ ਚੁਣਿਆਂ ਗਿਆ ਲੀਡਰ ਹੀ ਅੱਗੇ ਤੈਅ ਕਰ ਸਕਦਾ ਹੈ ਕਿ ਸਰਕਾਰੀ ਖਰਚੇ ਨੂੰ ਆਪਣੇ ਉਦਯੋਗ ਵਿੱਚ ਜਾਂ ਫਿਰ ਆਪਣੇ ਵਾਤਾਵਰਨ ਵਿੱਚ ਜਾਂ ਆਪਣੀ ਲਕੈਲਟੀ ਦੇ ਵਿੱਚ ਕਿੱਦਾਂ ਉਹਨੂੰ ਵਰਤਿਆ ਜਾਵੇ ਅਤੇ ਲੀਡਰਾਂ ਦੇ ਹੱਥ ਹੀ ਅੱਜ ਕੱਲ੍ਹ ਸਭ ਕੁਝ ਚੱਲਦਾ ਹੈ ਆਮ ਬੰਦਿਆਂ ਨੂੰ ਉਪਰਾਲੇ ਆਪਣੇ ਲੈਵਲ 'ਤੇ ਕਰਨੇ ਚਾਹੀਦੇ ਹਨ ਪਰ ਜੇ ਇੱਕ ਪੂਰੇ ਪੰਜਾਬ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਲੀਡਰਾਂ ਨੂੰ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਨੂੰ ਆਪਣੇ ਪੁਫ ਦਿਮਾਗ ਫੁਲ ਮਾਇੰਡ ਹੋ ਕੇ ਹੀ ਸਾਰੇ ਫੈਸਲੇ ਕਰਨੇ ਚਾਹੀਦੇ ਹਨ ਬਲਕਿ ਇਸ ਤੋਂ ਬਾਅਦ ਐਜੂਕੇਸ਼ਨ ਅਤੇ ਸਕਿਲਡ ਡਿਵੈਲਪਮੈਂਟ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਨਾਲ ਹੀ ਇੱਕ ਬੇਸਿਕ ਲੈਵਲ ਆਫ ਨਾਲੇਜ ਬੰਦਿਆਂ ਦੇ ਵਿੱਚ ਆਏਗਾ ਜਾਂ ਕਿ ਜਿਹਦੇ ਵਿੱਚ ਉਹ ਸਮਝ ਸਕਣਗੇ ਵੀ ਕੀ ਸਹੀ ਹੈ ਅਤੇ ਕੀ ਗਲਤ ਹੈ ਇਹਨੂੰ ਅੱਗੇ ਐਜੂਕੇਸ਼ਨ ਵਿੱਚ ਇਸ 'ਚ ਵਾਧਾ ਕਰਕੇ ਆਪਾਂ ਸਕਿਲ ਡਿਵੈਲਪਮੈਂਟ ਵੱਲ ਵੱਧ ਸਕਦੇ ਹਾਂ ਯਾਨੀ ਕਿ ਹੱਥੀ ਕੰਮ ਵਗੈਰਾ ਜਾਂ ਸਮਝ ਹੋਣੀ ਕੰਮਾਂ ਦੀ ਇਹ ਇੱਕ ਬੇਸਿਕ ਐਜੂਕੇਸ਼ਨ ਤੋਂ ਬਿਨਾਂ ਨਹੀਂ ਕੀਤੇ ਜਾ ਸਕਦੇ ਤਾਂ ਇਹ ਸਾਰੇ ਚੀਜ਼ਾਂ ਬਹੁਤ ਜ਼ਰੂਰੀ ਹਨ ਅਤੇ ਇੱਕ ਇੱਕ ਇੰਡੀਵਿਜੁਅਲ ਲੈਵਲ ਤੋਂ ਲੈ ਕੇ ਵੱਡੇ ਲੀਡਰ ਤੱਕ ਸਾਰਿਆਂ ਨੂੰ ਆਪਣਾ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ